ਜੇਕਰ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਸੱਭਿਆਚਾਰਕ ਵਿੱਚ ਮੁੱਖ ਕਿੱਤੇ ਦੀ ਤਾਂ ਪੰਜਾਬੀ ਸੱਭਿਆਚਾਰਕ ਵਿੱਚ ਖੇਤੀਬਾੜੀ ਨੂੰ ਮੁੱਖ ਕਿੱਤਾ ਮੰਨਿਆਂ ਜਾਂਦਾ ਹੈ ਇਹ ਤੋਂ ਇਲਾਵਾ ਪਸ਼ੂ ਪਾਲਣ ਵੀ ਮੁੱਖ ਕਿੱਤੇ ਦੇ ਵਿੱਚ ਆਉਂਦਾ ਹੈ ਖੇਤੀਬਾੜੀ ਦੀ ਅਗਰ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਇਹਨਾਂ ਨੂੰ ਮੌਸਮ ਦੇ ਅਨੁਸਾਰ ਕੀਤਾ ਜਾਂਦਾ ਹੈ ਹਰ ਇੱਕ ਮੌਸਮ ਦੇ ਵਿੱਚ ਵੱਖ ਵੱਖ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਮੁੱਖ ਤੌਰ 'ਤੇ ਸਾਉਣੀ ਅਤੇ ਹਾੜੀ ਦੀ ਖੇਤੀ ਕੀਤੀ ਜਾਂਦੀ ਹੈ ਸਾਉਣੀ ਦੇ ਵਿੱਚ ਸਾਉਣ ਦੇ ਵਿੱਚ ਅਲੱਗ ਖੇਤੀ ਕੀਤੀ ਜਾਂਦੀ ਹੈ ਅਤੇ ਹਾੜੀ ਦੇ ਵਿੱਚ ਸਾਉਣ ਤੋਂ ਅਲੱਗ ਖੇਤੀ ਕੀਤੀ ਜਾਂਦੀ ਹੈ ਸੋ ਇਹ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਮੌਸਮ ਹੈ ਹਾੜੀ ਚੱਲ ਰਹੀ ਹੈ ਜਾਂ ਸਾਉਣ ਚੱਲ ਰਿਹਾ ਹੈ ਜੇਕਰ ਆਪਾਂ ਗੱਲ ਕਰੀਏ ਅੱਜ ਦੀ ਨੌਜਵਾਨ ਪੀੜ੍ਹੀ ਦੀ ਤਾਂ ਉਹ ਆਪਣੇ ਕਿੱਤੇ ਤੋਂ ਵਾਂਝੇ ਹੁੰਦੇ ਜਾ ਰਹੇ ਆ ਕਿਉਂਕਿ ਖੇਤੀਬਾੜੀ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਪਸ਼ੂ ਪਾਲਣ ਦੇ ਵਿੱਚ ਵੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਬਟ ਅੱਜ ਕੱਲ੍ਹ ਦੇ ਨੌਜਵਾਨ ਨੇ ਉਹ ਸ਼ੋਰਟਕੱਟ ਅਪਣਾ ਕੇ ਜ਼ਿਆਦਾ ਆਪਣੇ ਆਪ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ ਨਾ ਕਿ ਉਹ ਮਿਹਨਤ 'ਤੇ ਯਕੀਨ ਰੱਖਦੇ ਹਨ ਇੱਕ ਕਿੱਤਾ ਖੇਤੀਬਾੜੀ ਜਿਹੜਾ ਕਿੱਤਾ ਏ ਉਹ ਮਿਹਨਤ ਮੰਗਦਾ ਹੈ ਉਹ ਮਜ਼ਦੂਰ ਦੀ ਇੱਕ ਮਿਹਨਤ ਮੰਗਦਾ ਹੈ ਜਿੰਨਾਂ ਤੁਸੀਂ ਉਹਦੇ ਵਿੱਚ ਆਪਣਾ ਹੰਡਰਡ ਪ੍ਰਸੈਂਟ ਦਉਂਗੇ ਉਨ੍ਹਾਂ ਜ਼ਿਆਦਾ ਤੁਹਾਨੂੰ ਉਹਦਾ ਰਿਜ਼ਲਟ ਦੇਖਣ ਨੂੰ ਮਿਲਦਾ ਹੈ ਕਿਉਂਕਿ ਜਿਹੜੀ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਆ ਉਹ ਆਪਣਾ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਸੈੱਟ ਹੋ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਡੇ ਦੇਸ਼ ਆ ਸਾਡੇ ਸਟੇਟਸ 'ਤੇ ਇਹ ਚੀਜ਼ ਸਾਡੇ ਸਟੇਟਸ ਨੂੰ ਸੂਟ ਨਹੀਂ ਕਰਦੀ ਸੋ ਉਹ ਬਾਹਰ ਜਾ ਕੇ ਹੋਰ ਦੂਜੀਆਂ ਮਜ਼ਦੂਰੀ ਕਰਨਾ ਤਾਂ ਆਪਣੇ ਆਪ ਨੂੰ ਇੱਕ ਆਪਣੇ ਸਟੇਟਸ ਦਾ ਨਜ਼ਰੀਆ ਮੰਨਦੇ ਨੇ ਪਰ ਆਪਣੇ ਪੰਜਾਬ ਵਿੱਚ ਰਹਿ ਕੇ ਖੇਤੀਬਾੜੀ ਆਪਣੇ ਸੱਭਿਆਚਾਰਕ ਕਿੱਤੇ ਨੂੰ ਉਹ ਅਪਣਾ ਨਹੀਂ ਰਹੇ ਉਹਨੂੰ ਨਕਾਰ ਰਹੇ ਨੇ ਸੋ ਇਹ ਆਪਣੇ ਪੰਜਾਬ ਦੇ ਲਈ ਬਹੁਤ ਜ਼ਿਆਦਾ ਹੈਰਾਨੀ ਦੀ ਅਤੇ ਬਹੁਤ ਜ਼ਿਆਦਾ ਨੁਕਸਾਨਦਾਇਕ ਚੀਜ਼ ਸਾਬਤ ਹੋ ਰਹੀ ਹੈ